ਜਰੂਰ ਮੈਂ ਤੁਹਾਨੂੰ ਭੰਗੜੇ ਦੀ ਮਹੱਤਤਾ ਤੇ ਇਸ ਦੀ ਪ੍ਰਸਿਧੀ ਬਾਰੇ ਦੱਸ ਸਕਦਾ ਹਾਂ ਭੰਗੜੇ ਦੀ ਮਹੱਤਤਾ ਭੰਗੜਾ ਇੱਕ ਨਾਚ ਨਹੀਂ ਸਭ ਪੰਜਾਬੀ ਸਭਿਆਚਾਰ ਦਾ ਇੱਕ ਅਨਿਖ੍ਰਵਾ ਅੰਗ ਹੈ ਇਸਦੀ ਮਹੱਤਤਾ ਨੂੰ ਹੇਠ ਦਿੱਤੇ ਬਿਨ ਦੁਆਰਾ ਹੀ ਸਮਝਾਇਆ ਜਾ ਸਕਦਾ ਹੈ ਖੁਸ਼ੀ ਦਾ ਪ੍ਰਗਟਾਵਾ ਭੰਗੜਾ ਖੁਸ਼ੀ ਉਤਸਾਹ ਅਤੇ ਜਸ਼ਨ ਦਾ ਪ੍ਰਤੀਕ ਹੈ ਇਹ ਬਾਢੀ ਦੇ ਸਮੇਂ ਵਿਆਹਾ ਤਿਓਹਾਰਾ ਤੇ ਹੋਰ ਖੁਸ਼ੀ ਦੇ ਮੌਕੇ ਤੇ ਨੱਚਾ ਜਾਂਦਾ ਹੈ ਸੱਭਿਆਚਾਰ ਪਹਿਚਾਣ ਭੰਗੜਾ ਪੰਜਾਬੀਆਂ ਦੀ ਸੱਭਿਆਚਾਰ ਪਹਿਛਾਣ ਦਾ ਪ੍ਰਤੀਕ ਹੈ ਇਹ ਉਹਨਾਂ ਦੀਆਂ ਜੜਾਂ ਵਿਰਸੇ ਤੇ ਆਵਾਜ਼ਾਂ ਨੂੰ ਦਰਸਾਉਂਦਾ ਹੈ ਸਰੀਰਕ ਸਹਿਤ ਭੰਗੜਾ ਇੱਕ ਸਰੀਰਕ ਤੌਰ ਤੇ ਮੰਗ ਕਰਨ ਵਾਲਾ ਨਾਚ ਹੈ ਇਸ ਨੂੰ ਜਾਂਚ ਕੇ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਮਨ ਪ੍ਰਸੰਨ ਰਹਿੰਦਾ ਹੈ ਸਮਾਜਿਕ ਬੰਧਨ ਭੰਗੜਾ ਲੋਕਾਂ ਨੂੰ ਇਕੱਠੇ ਲਿਆਉਣ ਦਾ ਹੈ ਅਤੇ ਸਮਾਜਿਕ ਬੰਧਨਾ ਨੂੰ ਮਜਬੂਤ ਬਣਾਉਂਦਾ ਹੈ ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਤੋਂ ਬਾਹਰ ਵੀ ਬਹੁਤ ਪ੍ਰਸਿੱਧ ਹੋ ਚੁੱਕਾ ਹੈ ਪੰਜਾਬੀ ਡਾਇਸਪੋਰਾ ਦੇ ਕਾਰਨ ਭੰਗੜਾ ਹੁਣ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਖਾਸ ਕਰਕੇ ਬਰਤਾਨੀਆ ਕੈਨੇਡਾ ਅਮਰੀਕਾ ਅਤੇ ਆਸਟਰੇਲੀਆ ਵਿੱਚ ਭੰਗੜੇ ਦੇ ਸ਼ੌਕੀਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਦੁਨੀਆਂ ਦੇ ਵਿੱਚ ਭੰਗੜੇ ਦੀ ਲੋਕ ਪ੍ਰੀਆ ਬਹੁਤ ਜਿਆਦਾ ਹੋ ਚੁੱਕੀ ਹੈ ਭੰਗੜੇ ਦੀ ਇਸ ਵਿਸ਼ਵ ਵਿਆਪੀ ਪ੍ਰਸਿੱਧੀ ਦੇ ਕਾਰਨ ਇਸ ਨਾਚ ਨੇ ਆਪਣੇ ਅੰਦਰ ਕਈ ਨਵੇਂ ਤੱਤਾਂ ਨੂੰ ਜਜਬ ਕੀਤਾ ਹੈ ਅਤੇ ਹੁਣ ਇੱਕ ਅੰਤਰਰਾਸ਼ਟਰੀ ਸੱਭਿਆਚਾਰ ਪ੍ਰਤੀਕ ਬਣ ਚੁੱਕਾ ਹੈ ਭਗੜਾ ਦੁਨੀਆ ਦਾ ਪਾਉਣ ਵਾਲਾ ਬਹੁਤ ਹੀ ਪ੍ਰਸਿੱਧ ਪ੍ਰਸਿੱਧ ਹੋ ਚੁੱਕਾ ਦੁਨੀਆ ਵਿੱਚ ਬਹੁਤ ਹੀ ਪ੍ਰਸਿੱਧ ਹੋ ਚੁੱਕਾ ਹੈ ਬੱਚਾ ਬੱਚਾ ਭੰਗੜੇ ਦਾ ਸ਼ਕੀਨ ਹੋ ਚੁੱਕਾ ਹੈ